ਅਸੀਂ ਕਿਤਾਬਾਂ ਮਾਈ ਸਭਾ ਦੇ ਬਜ਼ਾਰ ਜਿਹੜਾ ਕਿ ਦਰਬਾਰ ਸਾਹਿਬ ਦੇ ਕੋਲ ਹੈ ਘੰਟਾ ਘਰ ਵੱਲ ਚੌਂਕ ਵਾਲੇ ਪਾਸੇ ਉੱਥੋਂ ਖਰੀਦਦੇ ਹਾਂ ਇੱਥੋਂ ਕਿਤਾਬਾਂ ਬੜੀਆਂ ਹੀ ਸਸਤੀਆਂ ਮਿਲ ਜਾਂਦੀਆਂ ਹਨ ਅਤੇ ਨਾਲ ਦੀ ਨਾਲ ਹੀ ਸਾਨੂੰ ਸੈਕਿੰਡ ਹੈਂਡ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਇਨ੍ਹਾਂ ਹੀ ਜਿਵੇਂ ਕਿ ਦਰਸ਼ਨ ਬੁੱਕ ਡਿਪੂ ਹੋ ਗਿਆ ਉੱਥੇ ਦੋ ਹੀ ਕਿਤਾਬਾਂ ਦੇ ਦੁਕਾਨਾਂ ਹਨ ਜਿਹਨਾਂ ਤੋਂ ਇਹ ਕਿਤਾਬਾਂ ਮਿਲ ਜਾਂਦੀਆਂ ਅਤੇ ਤੁਹਾਨੂੰ ਉੱਥੋਂ ਹਰ ਪ੍ਰਕਾਰ ਦੀ ਕਿਤਾਬ ਮਿਲ ਜਾਏਗੀ ਚਾਹੇ ਸਕੂਲ ਦੀ ਹੋਵੇ ਚਾਹੇ ਕਾਲਜ ਦੀ ਹੋਵੇ ਚਾਹੇ ਯੂਨੀਵਰਸਿਟੀ ਦੀ ਹੋਵੇ ਚਾਹੇ ਕੋਈ ਕੰਪੀਟੀਟਿਵ ਇਗਜ਼ਾਮ ਨਾਲ ਰਿਲੇਟਡ ਕਿਤਾਬ ਕਿਉਂ ਨਾ ਹੋਵੇ ਛੋਟੇ ਬੱਚਿਆਂ ਦੀਆਂ ਹੋਣ ਚਾਹੇ ਵੱਡੇ ਬੱਚਿਆਂ ਦੀਆਂ ਹੋਣ ਕਿਤਾਬਾਂ ਤੁਹਾਨੂੰ ਹਰ ਪ੍ਰਕਾਰ ਦੀਆਂ ਮਿਲ ਜਾਣਗੀਆਂ ਗਰੀਬ ਬੱਚੇ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਨਹੀਂ ਹਨ ਉਹਨਾਂ ਨੂੰ ਉੱਥੋਂ ਸੈਕਿੰਡ ਹੈਂਡ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਅਤੇ ਉਹ ਇਸ ਗੱਲ ਨੂੰ ਵੀ ਪ੍ਰਮੋਟ ਕਰਦੇ ਹਨ ਕਿ ਅਸੀਂ ਆਪਣੀਆਂ ਪੁਰਾਣੀਆਂ ਕਿਤਾਬਾਂ ਉਹਨਾਂ ਨੂੰ ਵੇਚੀਏ ਤਾਂ ਕਿ ਕਿਸੇ ਗਰੀਬ ਦੇ ਕੰਮ ਵੀ ਆ ਸਕਣ ਸੋ ਉੱਥੋਂ ਹਾਨੂੰ ਸਾਨੂੰ ਹਰ ਪ੍ਰਕਾਰ ਦੀਆਂ ਸੈਕਿੰਡ ਹੈਂਡ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਅਤੇ ਨਾਲ ਹੀ ਨਾਲ ਨਵੀਆਂ ਵੀ ਮਿਲ ਜਾਂਦੀਆਂ ਹਨ ਉਹ ਕਿਤਾਬਾਂ ਖਰੀਦਣ ਵਾਲੇ 'ਤੇ ਡਿਪੈਂਡ ਕਰਦਾ ਹੈ ਕਿ ਉਸ ਨੂੰ ਕਿਸ ਪ੍ਰਕਾਰ ਦੀਆਂ ਕਿਤਾਬਾਂ ਚਾਹੀਦੀਆਂ ਹਨ ਪੁਰਾਣੀਆਂ ਕਿਤਾਬਾਂ ਵੀ ਖਰਾਬ ਨਹੀਂ ਹੁੰਦੀਆਂ ਬਿਲਕੁਲ ਸਾਫ ਸੁਥਰੀਆਂ ਹੁੰਦੀਆਂ ਹਨ ਅੱਛੀ ਕੰਡੀਸ਼ਨ ਵਿੱਚ ਹੁੰਦੀਆਂ ਹਨ ਸੋ ਮੈਂ ਤਾਂ ਇਹੀ ਕਵਾਂਗਾ ਕਿ ਨਵੀਆਂ ਕਿਤਾਬਾਂ ਖਰੀਦਣ ਦੀ ਬਜਾਏ ਸਾਨੂੰ ਸੈਕਿੰਡ ਹੈਂਡ ਕਿਤਾਬਾਂ ਹੀ ਖਰੀਦ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੇ ਪੈਸੇ ਬਚਾ ਲੈਣੇ ਚਾਹੀਦੇ ਹਨ ਅਤੇ ਜਿਹੜੇ ਲੋਕਾਂ ਪੜ੍ਹ ਚੁੱਕੇ ਹਨ ਉਹ ਆਪਣੀਆਂ ਕਿਤਾਬਾਂ ਨੂੰ ਵੇਚ ਵੀ ਦੇਣ ਉਹਨਾਂ ਨੂੰ ਵੀ ਅੱਛੇ ਪੈਸੇ ਮਿਲ ਜਾਂਦੇ ਹਨ ਧੰਨਵਾਦ